ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਉਬਰ ਕੈਬ ਕੰਪਨੀ 'ਚੋਂ ਬੋਲਦੇ ਹੋ ਸਰ ਅਸੀਂ ਕੈਬ ਬੁੱਕ ਕੀਤੀ ਸੀ ਇੱਕ ਪਰ ਹੈ ਨਾ ਕੁਛ ਕਾਰਨਾਂ ਕਰਕੇ ਨਾ ਸਾਨੂੰ ਉਹ ਕੈਂਸਲ ਕਰਨੀ ਪਈ ਠੀਕ ਹੈ ਅਸੀਂ ਨਾ ਪੈਸੇ ਦਿੱਤੇ ਸੀ ਐਡਵਾਂਸ ਦਿੱਤਾ ਸੀ ਤਿੰਨ ਹਜ਼ਾਰ ਅਤੇ ਹੈ ਨਾ ਹੁਣ ਸਾਡੀ ਕੈਬ ਕੈਂਸਲ ਹੋ ਗਈ ਹੈ ਸੋ ਸਾਨੂੰ ਪੈਸੇ ਨਾ ਰਿਫੰਡ ਚਾਹੀਦੇ ਆ ਤੁਸੀਂ ਗੂਗਲ ਪੇ ਕਰ ਦਿਓ ਜਾਂ ਪੇਟੀਐੱਮ ਕਰ ਦਿਓ ਮੋਬਾਇਲ ਨੰਬਰ ਤੁਹਾਨੂੰ ਸੈਂਡ ਕਰ ਦਿੰਦੀ ਹਾਂ ਤੁਹਾਡੇ ਨੰਬਰ 'ਤੇ ਜੇ ਤੁਹਾਡੀ ਇੱਛਾ ਹੈ ਤਾਂ ਬੈਂਕ ਅਕਾਊਂਟ ਨੰਬਰ ਵੀ ਸੈਂਡ ਕਰ ਦਿੰਦੀ ਹਾਂ ਤੁਸੀਂ ਚਾਹੋ ਤਾਂ ਮੇਰੇ ਬੈਂਕ 'ਚ ਟ੍ਰਾਂਸਫਰ ਕਰ ਸਕਦੇ ਹੋ ਥੈਂਕ ਯੂ ਸਰ